ਹਾਂਜੀ ਹਾਂਜੀ ਦੱਸੋ ਹਾਂਜੀ ਕਾਰਨ ਕਾਰਨ ਤਾਂ ਦੇਖੋ ਆਪਾਂ ਹੁਣ ਕਿਸੇ ਇੱਕ ਨੂੰ ਤਾਂ ਠਹਿਰਾ ਨਹੀਂ ਸਕਦੇ ਉੱਪਰੋਂ ਉਹਨਾਂ ਨੇ ਪਾਣੀ ਇੰਨਾ ਛੱਡ ਦਿੱਤਾ ਕਿ ਸਾਡੇ ਤਾਂ ਇੱਧਰ ਡੈਮ ਮਤਲਬ ਕਿ ਇੰਨਾ ਜ਼ਿਆਦਾ ਪਾਣੀ ਹੋ ਗਿਆ ਸੀਗਾ ਓਵਰ ਫਲੋ ਹੋ ਗਿਆ ਸੀਗਾ ਕਿ ਬਹੁਤ ਨੁਕਸਾਨ ਹੋਇਆ ਇੱਧਰ ਤਾਂ

ਹਾਂਜੀ ਹੁਣ ਹਾਂਜੀ ਉਹ ਤਾਂ ਹੈ ਬਹੁਤ ਨੁਕਸਾਨ ਹੋਇਆ ਖੇਤਾਂ ਵਗੈਰਾ ਦੇ ਵੀ ਅਤੇ ਓਦਾਂ ਵੀ ਮਤਲਬ ਹੁਣ ਆਪਾਂ ਕਿਹਨੂੰ ਕਿਹਨੂੰ ਕਸੂਰਵਾਰ ਠਹਿਰਾ ਸਕਦੇ ਹਾਂ ਨਾ ਉਹਨਾਂ ਨੇ ਪਾਣੀ ਇੰਨਾ ਛੱਡ ਹਾਂਜੀ ਸਾਨੂੰ ਤਾਂ ਬਹੁਤ ਨੁਕਸਾਨ ਹੋਇਆ ਸਾਡੇ ਵੱਲੋਂ ਤਾਂ ਪੂਰੀ ਕੋਸ਼ਿਸ਼ ਸੀਗੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਪਾਣੀ ਦਾ ਵਹਾ ਜਿਹੜਾ ਰੋਕਿਆ ਜਾਵੇ ਪਾਣੀ ਕਿਸੇ ਹੋਰ ਬੰਨੇ ਨੂੰ ਕਰ ਦਿੱਤਾ ਜਾਵੇ ਤਾਂ ਜੋ ਪਿੰਡ ਬਚ ਜਾਵੇ ਖੇਤ ਬਚ ਜਾਣ ਮਾਲ ਡੰਗਰ ਬੱਚ ਜੇ ਪਰ ਹੁਣ ਕੀ ਕਰ ਸਕਦੇ ਉਹਨਾਂ ਨੇ ਉਪਰੋਂ ਪਾਣੀ ਇੰਨਾ ਛੱਡ ਦਿੱਤਾ ਸੀਗਾ ਡੈਮ ਥੋੜ੍ਹਾ ਜਿਹਾ ਕਰੈਕ ਹੋ ਗਿਆ ਸੀਗਾ ਸਾਰਾ ਪਾਣੀ ਫਿਰ ਪਿੰਡ 'ਚ ਫੈਲ ਗਿਆ ਬਹੁਤ ਮੁਸ਼ਕਲ ਨਾਲ ਸਾਰੇ ਬਚੇ ਆ ਕਈਆ ਦਾ ਤਾਂ ਜਾਨੀ ਨੁਕਸਾਨ ਵੀ ਹੋ ਗਿਆ ਹਾਂਜੀ ਬਿਲਕੁਲ

ਹਾਂਜੀ ਖੇਤਾਂ 'ਚ ਬਹੁਤ ਨੁਕਸਾਨ ਹੋਇਆ ਜਿਹੜੇ ਹੁਣ ਹੈਗੇ ਇਕੱਲੇ ਫਾਰਮਰ ਆ ਉਹਨਾਂ ਨੂੰ ਹੁਣ ਕਿਸੇ ਪਾਸੇ ਤਾਂ ਹੋਰ ਪੈਸਾ ਨਹੀਂ ਬਚ ਬਣ ਸਕਦਾ ਨਾ ਕਾਫੀ ਆਰਥਿਕ ਹਾਲਾਤ ਵੀ ਖ਼ਰਾਬ ਹੋ ਗਿਆ ਸਾਡੇ ਇੱਧਰ ਦੇ ਤਾਂ ਹੁਣ ਕਿਸਨੂੰ ਰਿਸਪੋਨਸੀਬਲ ਠਹਿਰਾ ਸਕਦੇ ਹਾਂ ਮੈਮ ਸਾਡੇ ਵੱਲੋਂ ਤਾਂ ਹੁਣ ਪੂਰੀ ਕੋਸ਼ਿਸ਼ ਕੀਤੀ ਸੀਗੀ ਕਿ ਜਿੰਨਾ ਨੁਕਸਾਨ ਘੱਟ ਹੋਵੇ ਓਨੀ ਕੋਸ਼ਿਸ਼ ਕੀਤੀ ਜਾਵੇ ਹਾਂਜੀ ਹਾਂਜੀ ਬਹੁਤ ਕੋਸ਼ਿਸ਼ ਕੀਤੀ ਸੀ ਪਰ ਹੁਣ ਕੀ ਕਰ ਸਕਦੇ ਹਾਂ ਜੋ ਰੱਬ ਨੇ ਲਿਖਿਆ ਹੋਵੇ ਉਹ ਤਾਂ ਹੋਣਾ ਹੀ ਆ ਕੋਈ ਨਹੀਂ ਅਗਰ ਤੁਸੀਂ ਕਿਸੇ ਹੋਰ ਚੀਜ਼ ਬਾਰੇ ਇਨਫੋਰਮੇਸ਼ਨ ਲੈਣੀ ਹੋਈ ਤਾਂ ਤੁਸੀਂ ਦੁਬਾਰਾ ਕਾਲ ਕਰ ਲਿਓ ਕੋਈ ਨਹੀਂ ਹਾਂਜੀ ਹਾਂਜੀ ਕੋਈ ਨਹੀਂ ਅਗਰ ਤੁਸੀਂ ਕੋਈ ਹੋਰ ਇਨਫੋਰਮੇਸ਼ਨ ਲੈਣੀ ਹੋਈ ਤਾਂ ਤੁਸੀਂ ਪੁੱਛ ਲਿਓ ਕਈ ਗੱਲ ਨਹੀਂ ਮੈਨੂੰ ਕਾਲ ਕਰਕੇ ਹਾਂਜੀ ਧੰਨਵਾਦ ਧੰਨਵਾਦ